ਸਾਡੇ ਪੰਜਾਬ ਵਿੱਚ ਵਪਾਰਕ ਖੇਤਰ ਸਮਾਜਿਕ ਅਤੇ ਵਾਤਾਵਰਣ ਪ੍ਰਭਾਵ ਨੂੰ ਕੀ ਕਿਵੇਂ ਘੱਟ ਕਰ ਕੀਤਾ ਜਾ ਸਕਦਾ ਹੈ ਸਾਡੇ ਦੇਸ਼ ਦੇ ਵਿੱਚ ਲੋਕਾਂ ਨੂੰ ਕੋਈ ਪਤਾ ਨਹੀਂ ਹੈ ਕਿ ਪਾਣੀ ਖ਼ਤਮ ਹੋ ਰਿਹਾ ਹੈ ਪਾਣੀ ਦੀ ਕਮੀ ਬਹੁਤ ਜ਼ਿਆਦਾ ਆ ਰਹੀ ਹੈ ਲੋਕੀ ਪਾਣੀ ਧੜਾ ਧੜ ਰੋੜ੍ਹ ਕੇ ਖ਼ਤਮ ਕਰ ਰਹੇ ਹਨ ਕੱਪੜੇ ਮਸ਼ੀਨਾਂ ਨਾਲ ਧੋਤੇ ਜਾਂਦੇ ਹਨ ਜਿਹੜਾ ਕੰਮ ਇੱਕ ਅੱਧੀ ਬਾਲਟੀ ਨਾਲ ਹੁੰਦਾ ਹੈ ਹੁਣ ਉਹ ਦਸ ਦਸ ਬਾਲਟੀਆਂ ਉਹਦੇ ਵਾਸਤੇ ਰੁੜਦੀਆਂ ਹਨ ਟੋਇਲਟ ਸੀਟ ਦੇ ਵਿੱਚ ਅਸੀਂ ਫਜੂਲ ਦਾ ਪਾਣੀ ਵੇਸਟ ਕਰਦੇ ਹਾਂ ਇੱਕ ਬੰਦਾ ਟੋਇਲਟ ਜਾ ਕੇ ਆਉਂਦਾ ਹੈ ਤਾਂ ਡੇਢ ਦੋ ਬਾਲਟੀਆਂ ਦਾ ਪਾਣੀ ਰੁੜ੍ਹਦਾ ਹੈ ਜਿਹਦੇ ਨਾਲ ਆਉਣ ਵਾਲੇ ਸਮੇਂ ਵਿੱਚ ਆਉਣ ਵਾਲੇ ਦਸ ਬਾਰ੍ਹਾਂ ਸਾਲਾਂ ਦੇ ਵਿੱਚ ਪਾਣੀ ਧਰਤੀ 'ਤੇ ਖ਼ਤਮ ਹੋਣਾ ਸ਼ੁਰੂ ਹੋ ਗਿਆ ਹੈ ਜਿਸ ਦੀ ਅਵੇਅਰਨੈਸ ਸਾਨੂੰ ਨਹੀਂ ਹੈ ਅਤੇ ਸਾਡੇ ਬ ਪਾਪੂਲੇਸ਼ਨ ਦਿਨ ਬ ਦਿਨ ਇੰਨੀ ਵੱਧ ਰਹੀ ਹੈ ਪਰ ਪੈਦਾਵਾਰ ਉੰਨੀ ਨਹੀਂ ਵੱਧ ਰਹੀ ਇਸ ਲਈ ਕੀ ਕਰ ਰਹੇ ਹਨ ਕਿ ਗਲਤ ਮਲਤ ਜਿਹੜੇ ਉਹ ਕੈਮੀਕਲ ਪਾ ਪਾ ਕੇ ਆ ਅਸੀਂ ਸਬਜ਼ੀਆਂ ਉਗਾ ਰਹੇ ਹਨ ਉਹ ਕੈਂਸਰ ਦਾ ਘਰ ਬਣ ਰਹੇ ਹਨ ਲੋਕ ਮਿਲਾਵਟਾ ਕਰ ਰਹੇ ਹਨ ਇੰਨੇ ਪਾਪੂਲੇਸ਼ਨ ਦੇ ਲ ਜਿੰਨੀ ਜਿੰਨੀ ਜਨਸੰਖਿਆ ਵੱਧ ਰਹੀ ਹੈ ਉੰਨਾਂ ਦੁੱਧ ਨਹੀਂ ਪੈਦਾਵਾਰ ਹੋ ਰਿਹਾ ਅਤੇ ਲੋਕ ਹੁਣ ਨਕਲੀ ਦੁੱਧ ਬਣਾ ਬਣਾ ਕੇ ਵੇਚ ਰਹੇ ਹਨ ਜਿਹਦੇ ਨਾਲ ਬਿਮਾਰੀਆਂ ਵੱਧ ਰਹੀਆਂ ਹਨ ਲੋਕਾਂ ਦੀਆਂ ਵਿੱਚ ਕੈਂਸਰ ਹੋਰ ਵੀ ਕਈ ਬਿਮਾਰੀਆਂ ਵੱਧ ਰਹੀਆਂ ਹਨ